ਹਾਂਜੀ ਮੈਂ ਇੱਕ ਲੋਇਡ ਦਾ ਡੇਢ ਟਨ ਦਾ ਏ ਸੀ ਲਿਆ ਅਤੇ ਉਹਦਾ ਮੇਰਾ ਨਾ ਐਕਸਪੀਰੀਅੰਸ ਬਹੁਤ ਮਾੜਾ ਰਿਹਾ ਮੈਂ ਦੋ ਹਜ਼ਾਰ ਇੱਕੀ ਦੇ ਵਿੱਚ ਇਹ ਨਵਾਂ ਲਿਆ ਜਦੋਂ ਮੈਂ ਕੈਨੇਡਾ ਤੋਂ ਵਾਪਸ ਆਇਆ ਅਤੇ ਮੇਰੇ ਘਰ ਮੈਨੂੰ ਜ਼ਰੂਰਤ ਲੱਗੀ ਅਤੇ ਮੈਂ ਲੋਇਡ ਦਾ ਮੈਨੂੰ ਰਿਕਮੈਂਡ ਕਰਿਆ ਮੇਰੇ ਕਿਸੇ ਖਾਸ ਯਾਰ ਦੋਸਤ ਨੇ ਵੀ ਲੋਇਡ ਦਾ ਮੇਰੇ ਘਰ ਲੱਗਿਆ ਹੋਇਆ ਬਹੁਤ ਵਧੀਆ ਮੈਂ ਉਹਦੇ ਕਹਿਣ 'ਤੇ ਲੋਇਡ ਦਾ ਏ ਸੀ ਲੈ ਲਿਆ ਅਤੇ ਮੇਰਾ ਉਹਦਾ ਐਕਸਪੀਰੀਅੰਸ ਬੜਾ ਬੈਡ ਰਿਹਾ ਬਹੁਤ ਜ਼ਿਆਦਾ ਗੰਦਾ ਰਿਹਾ ਕਿਉਂਕਿ ਇਹ ਪ੍ਰੋਡਕਟ ਹੀ ਇੱਕ ਦੇਸੀ ਹੈ ਪਰ ਕਹਿੰਦੇ ਆ ਵੀ ਐੱਲ ਜੀ ਦੀ ਲੈਂਥ ਹੈ ਇਹ ਐੱਲ ਜੀ ਦਾ ਨਾਲ ਦਾ ਪ੍ਰੋਡਕਟ ਹੈ ਪਰ ਮੈਨੂੰ ਚੰਗਾ ਨਹੀਂ ਲੱਗਿਆ ਕਿਉਂਕਿ ਲੋਇਡ ਦਾ ਪ ਪ੍ਰੋਡਕਟ ਐਡਾ ਗੰਦਾ ਸੀਗਾ ਇਹਦੀ ਸਰਵਿਸ ਬ ਸ ਸਰਵਿਸ ਸੈਂਟਰ ਬੜੇ ਮਾੜੇ ਹੈ ਸਰਵਿਸ ਕੇਅਰ ਬੜੀ ਮਾੜੀ ਹੇ ਸਰਵਿਸ ਸਟਰੈਂਥ ਬੜੀ ਮਾੜੀ ਹੈ ਸਰਵਿਸ ਵਾਸਤੇ ਮੈਂ ਲਿਖਿਆ ਵੀ ਮੇਰੀ ਸਰਵਿਸ ਹੋਣੀ ਚਾਹੀਦੀ ਹੈ ਮੇਰੇ ਏ ਸੀ ਦੀ ਸਿਕਸ ਮੰਨਥ ਹੋ ਗਏ ਹੈ ਪਰ ਉਹ ਤਕਰੀਬਨ ਤਿੰਨ ਮਹੀਨੇ ਬਾਅਦ ਸਰਵਿਸ ਦਾ ਇਹਨਾਂ ਨੇ ਬੰ ਮੁੰਡਾ ਭੇਜਿਆ ਸਰਵਿਸ ਕਰਨ ਉਹ ਇੱਕ ਸਿਰਫ ਡਰਾਈ ਸਰਵਿਸ ਕਰਕੇ ਚਲਾ ਗਿਆ ਨਾ ਕਿ ਉਹਨੇ ਵਾਟਰ ਵਾਲੀ ਕਰੀ ਵਾਟਰ ਸਰਵਿਸ ਬਿਲਕੁਲ ਨਹੀਂ ਕਰੀ ਅਤੇ ਮੇਰੇ ਕਹਿਣ 'ਤੇ ਉਹਦਾ ਜਿਹੜਾ ਬਿਹੇਵੀਅਰ ਸੀਗਾ ਐਡਾ ਬੈਡ ਸੀ ਵੀ ਮੈਂ ਉਹ ਤੋਂ ਕੰਮ ਕਰਵਾਉਣ ਦਾ ਮੈਨੂੰ ਇਹ ਡਰ ਸੀ ਵੀ ਇਹ ਕੋਈ ਏ ਸੀ ਦਾ ਕੋਈ ਇੱਦਾਂ ਪੁਆਇੰਟ ਖਰਾਬ ਹੀ ਨਾ ਕਰ ਜਾਵੇ ਮੈਂ ਉਹ ਤਕਰੀਬਨ ਅਠੱਤੀ ਹਜ਼ਾਰ ਦਾ ਏ ਸੀ ਲਿਆ ਸੀ ਡੇਟ ਟਨ ਦਾ ਸਪਲਿਟ ਏ ਸੀ ਮੈਂ ਦੋ ਸਾਲਾਂ 'ਚ ਏ ਸੀ ਤੋਂ ਐਡਾ ਪਰੇਸ਼ਾਨ ਹੋ ਗਿਆ ਵੀ ਮੈਂ ਉਹਨੂੰ ਵੀਹ ਹਜ਼ਾਰ 'ਚ ਕਿਸੇ ਨੂੰ ਵੇਚਿਆ ਅਤੇ ਵੇਚਣ ਤੋਂ ਬਾਅਦ ਮੈਂ ਕੋਈ ਹੋਰ ਪ੍ਰੋਡਕਟ ਦਾ ਏ ਸੀ ਲਵਾਇਆ ਅਤੇ ਲੋਇਡ ਦਾ ਮੇਰਾ ਬਹੁਤ ਜ਼ਿਆਦਾ ਪ੍ਰੋਡਕਟ ਤੋਂ ਬਹੁਤ ਜ਼ਿਆਦਾ ਮਨ ਟੁੱਟ ਗਿਆ ਅਤੇ ਇੱਕ ਤਾਂ ਇਹਨਾਂ ਦੇ ਸਰਵਿਸ ਸੈਂਟਰ ਬੜੇ ਦੂਰ ਦੂਰ ਹੈ ਸਰਵਿਸ ਦੀ ਕੁਆਲਿਟੀ ਨਹੀਂ ਹੈਗੀ ਸਰਵਿਸ ਦੀ ਜਿਹੜੇ ਸਰਵਿਸ ਕਰਨ ਆਉਂਦੇ ਮੁੰਡੇ ਉਹਨਾਂ ਦਾ ਬਿਹੇਵੀਅਰ ਬਹੁਤ ਬੜਾ ਗਲਤ ਹੈ